ਮੇਰੀ ਸੋਚ ਮੁਤਾਬਕ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਹੋਰ ਗ੍ਰਹਿ 'ਤੇ ਜੀਵਨ ਬੜਾ ਮੁਸ਼ਕਲ ਹੈ ਕਿਉਂਕਿ ਉੱਥੇ ਪਾਣੀ ਆ ਆਕਸੀਜਨ ਅਜੇ ਤੱਕ ਦੇ ਸ ਕਾਢਾਂ ਮੁਤਾਬਕ ਨਹੀਂ ਹੈ ਜੇਕਰ ਜਿਹੜਾ ਸਰੀਰ ਹੈ ਬੰਦੇ ਦਾ ਉਹਨੂੰ ਸੱਤਰ ਪ੍ਰਸੈਂਟ ਸਰੀਰ ਵਿੱਚ ਪਾਣੀ ਦੀ ਲੋੜ ਹੁੰਦੀ ਹੈ ਜੇਕਰ ਪਾਣੀ ਅਤੇ ਆਕਸੀਜਨ ਹੀ ਨਹੀਂ ਹੈ ਤਾਂ ਇਨਸਾਨ ਦਾ ਜਿਉਂਦਾ ਰਹਿਣਾ ਬੜਾ ਮੁਸ਼ਕਲ ਹੈ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਬਨਸਪਤੀ ਹੈ ਜੇਕਰ ਇਨਸਾਨ ਨੂੰ ਖਾਣ ਲਈ ਕੋਈ ਚੀਜ਼ ਨਹੀਂ ਮਿਲੇਗੀ ਧਰਤੀ 'ਤੇ ਵੀ ਇਨਸਾਨ ਖਾਧੇ ਬਿਨਾ ਨਹੀਂ ਰਹਿ ਸਕਦਾ ਤਾਂ ਕਿਸੇ ਹੋਰ ਗ੍ਰਹਿ 'ਤੇ ਤਾਂ ਕੀ ਰਹਿ ਸਕਦਾ ਹੈ ਅੱਜ ਦੇ ਹਿਸਾਬ ਨਾਲ ਕਿਸੇ ਹੋਰ 'ਤੇ ਇਹਦੇ ਸਿਧਾਂਤ ਮੁਤਾਬਕ ਕਿਤੇ ਵੀ ਜੀਵਨ ਰ ਰਹਿਣਾ ਮੁਸ਼ਕਲ ਹੈ